ਅਸੀਂ ਬਹੁਤ ਸਾਰੇ ਚੁਣੌਤੀਆਂ 'ਚ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ ਜਿਵੇਂ ਕਿ ਸੜਕ ਨੂੰ ਲੈ ਕੇ ਹੈ ਇਸ ਵਿੱਚ ਸੜਕ ਦਾ ਪ੍ਰਬੰਧ ਬਹੁਤ ਹੀ ਖ਼ਰਾਬ ਹੈ ਰੂਪਨਗਰ ਦੇ ਵਿੱਚ ਜਿੰਨਿਆਂ ਵੀ ਜ਼ਿਲ੍ਹੇ ਵਿੱਚ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਹੈ ਜਦੋਂ ਵੀ ਲੋਕ ਕਿਤੇ ਜਾਂਦੇ ਹਨ ਤਾਂ ਸੜਕਾਂ ਮੀਂਹ ਦੇ ਕਰਕੇ ਇੰਨੀਆਂ ਜ਼ਿਆਦਾ ਖ਼ਰਾਬ ਹੋ ਜਾਂਦੀਆਂ ਹਨ ਕਿ ਲੋਕਾਂ ਦਾ ਬਾਹਰ ਨਿਕਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਅਤੇ ਇੱਥੇ ਦੇ ਨੇਚਰ ਦੇ ਵਿੱਚ ਵੀ ਕਾਫ਼ੀ ਤਬਦੀਲੀਆਂ ਹਨ ਇੱਥੇ ਸਾ ਜ਼ਿਆਦਾ ਸਾਫ਼ ਸਫ਼ਾਈ ਨਹੀਂ ਹੈ ਜਿਹਦੇ ਕਰਕੇ ਲੋਕਾਂ ਨੂੰ ਬਹੁਤ ਗੰਦੀ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੋਰ ਵੀ ਕਈ ਤਰੀਕੇ ਦੀਆਂ ਸਮੱਸਿਆਵਾਂ ਹਨ ਜਿਹਨਾਂ ਨੂੰ ਅਸੀਂ ਦੱਸ ਸਕਦੇ ਹਾਂ ਜਿਵੇਂ ਕਿ ਪੇੜ ਪੌਦਿਆਂ ਨੂੰ ਲੈ ਕੇ ਪੇੜ ਪੌਦਿਆਂ ਦੀ ਬਹੁਤ ਜ਼ਿਆਦਾ ਕਟਾਈ ਹੁੰਦੀ ਹੈ ਜਿਹਦੇ ਕਰਕੇ ਪੇੜਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਅਤੇ ਲੋਕ ਕੂੜਾ ਕਰਕਟ ਸਿੱਟਦੇ ਜਾਂਦੇ ਹਨ ਜੋ ਕਿ ਸੜਕਾਂ ਦੇ ਉੱਤੇ ਹੀ ਖਿਲਰਿਆ ਰਹਿੰਦਾ ਹੈ